ਸੱਤ ਹਜ਼ਾਰ ਤਿੰਨ ਸੌ ਸਤਾਰਾਂ ਦੋ ਹਜ਼ਾਰ ਪੰਜਾਹ ਅੱਠ ਹਜ਼ਾਰ ਤਿੰਨ ਸੌ ਸਤਵੰਜਾ ਨੌ ਹਜ਼ਾਰ ਪੰਜ ਸੋ ਤਰੇਂਹਠ ਨੱਬੇ ਹਜ਼ਾਰ ਨੌ ਸੌ ਬੱਨਵੇ